ਭਾਰਤ ਵਿੱਚ ਮਨੋਰੰਜਨ ਦੇ ਦੋ ਵੱਡੇ ਸਾਧਨ ਹਨ ਜਿਵੇਂ ਕਿ ਫਿਲਮਾਂ ਅਤੇ ਖੇਡਾਂ ਔਰ ਫਿਲਮ ਇੰਡਸਟਰੀ ਇਹਦੇ ਵਿੱਚ ਬਹੁਤ ਪ੍ਰਸਿੱਧ ਰੂਪ ਲੈ ਚੁੱਕੀ ਹੈ ਔਰ ਇਹ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਹੈ ਔਰ ਕਈ ਤਰ੍ਹਾਂ ਦੇ ਫਿਲਮਾਂ ਟਾਈਮ ਟੂ ਟਾਈਮ ਆਉਂਦੀਆਂ ਰਹਿੰਦੀਆਂ ਹਨ ਔਰ ਲੋਕ ਇਹਨਾਂ ਫਿਲਮਾਂ ਨੂੰ ਦੇਖਣ ਦਾ ਬਹੁਤ ਸ਼ੌਕ ਰੱਖਦੇ ਹਨ ਜ਼ਿਆਦਾਤਰ ਸਿਨੇਮਾ ਘਰਾਂ ਵਿੱਚ ਵੀ ਫਿਲਮਾਂ ਦੇਖਦੇ ਹਨ ਟੀ ਵੀ ਵੀ ਇਸ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ ਔਰ ਉਹਦੇ ਵਿੱਚ ਕਈ ਤਰ੍ਹਾਂ ਦੇ ਮਨੋਰੰਜਨ ਦੇ ਪ੍ਰੋਗਰਾਮ ਵੀ ਆਉਂਦੇ ਹਨ ਔਰ ਲੋਕ ਇਹਨਾਂ ਪ੍ਰੋਗਰਾਮਾਂ ਨੂੰ ਵੱਖ ਵੱਖ ਟਾਈਮ 'ਤੇ ਪ੍ਰਾਈਮ ਟਾਈਮ 'ਤੇ ਵੀ ਦੇਖਣਾ ਪਸੰਦ ਕਰਦੇ ਹਨ ਜਿਵੇਂ ਕਿ ਕੌਣ ਬਣੇਗਾ ਕਰੋੜਪਤੀ ਔਰ ਕਪਿਲ ਸ਼ਰਮਾ ਸ਼ੋਅ ਜਿਹੜੇ ਕਿ ਬਹੁਤ ਪਾਪੂਲਰ ਹੋ ਚੁੱਕੇ ਹਨ ਹਰ ਲੋਕ ਹਰ ਵੇਲੇ ਇਸ ਨੂੰ ਦੇਖਣਾ ਪਸੰਦ ਚਾਹੁੰਦੇ ਹਨ